ਹੈਲੋ ਸਤਿ ਸ੍ਰੀ ਅਕਾਲ ਮੈਮ ਨਰਸ ਬੋਲਣਡੇ ਹੋ ਹਾਂ ਹਾਂਜੀ ਮੈਮ ਮੈਨੂੰ ਨਾ ਮੈਂ ਤੁਹਾਡੇ ਕੋਲ ਆਈ ਸੀਗੀ ਟ੍ਰੀਟਮੈਂਟ ਕਰਵਾਉਣ ਮੈਨੂੰ ਨਾ ਬਹੁਤ ਜ਼ਿਆਦਾ ਵੀਕਨੈਸ ਫੀਲ ਹੋ ਰਹੀ ਆ ਅਤੇ ਮੇਰੀਆਂ ਲੱਤਾਂ ਮੇਰਾ ਪੂਰਾ ਸਰੀਰ ਬਹੁਤ ਦਰਦ ਕਰਦਾ ਆ ਹਾਂਜੀ ਮੈਮ ਮੈਂ ਸੋਮਵਾਰ ਆਈ ਸੀਗੀ ਨਹੀਂ ਮੈਮ ਮੈਂ ਪਹਿਲਾਂ ਦਿਖਾਇਆ ਸੀਗਾ ਅਤੇ ਉਹਨਾਂ ਨੇ ਮੈਨੂੰ ਬਸ ਮੈਡੀਸਨ ਦੇ ਦਿੱਤੀ ਸੀ ਹਾਂਜੀ ਨਹੀਂ ਨਹੀਂ ਮੈਮ ਸ਼ੂਗਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਇਹੀ ਆ ਕਿ ਮੇਰੀ ਬੋਡੀ ਪੂਰੀ ਦਰਦ ਕਰਦੀ ਹੈ ਨਹੀਂ ਨਹੀਂ ਮੈਮ ਹੁਣੇ ਤੋਂ ਹੀ ਥੋੜ੍ਹੀ ਦੇਰ ਹੋਈ ਆ ਕੋਈ ਮਹੀਨਾ ਕੁ ਪਹਿਲਾਂ ਹੀ ਪਹਿਲਾਂ ਤਾਂ ਮੈਂ ਇਗਨੋਰ ਕਰਦੀ ਸੀ ਹੁਣ ਮੈਂ ਸੀਰੀਅਸਲੀ ਲਿਆ ਅਤੇ ਹੁਣ ਮੈਂ ਮੈਡੀਸਨ ਵੀ ਲਈ ਸੀਗੀ ਪਰ ਮੈਨੂੰ ਕੋਈ ਮਤਲਬ ਫ਼ਰਕ ਨਹੀਂ ਪਿਆ ਹਾਂਜੀ ਹਾਂਜੀ ਬਿਲਕੁਲ ਕਈ ਵਾਰ ਮੈਨੂੰ ਫੀਲ ਹੁੰਦਾ ਵਾ ਬਹੁਤ ਜ਼ਿਆਦਾ ਵੀਕਨੈਸ ਹੋ ਜਾਂਦੀ ਕਈ ਵਾਰ ਚੱਕਰ ਆਉਂਦੇ ਆ ਅਤੇ ਪੂਰੀ ਬੋਡੀ ਜਿਹੜੀ ਹੈ ਦਰਦ ਕਰਦੀ ਆ ਹਾਂਜੀ ਹਾਂਜੀ ਮੈਮ ਤੁਸੀਂ ਮੈਨੂੰ ਇੰਨਾ ਦੱਸ ਦਿਓ ਤੁਸੀਂ ਕਿੰਨੇ ਨੰਬਰ ਰੂਮ 'ਚ ਮਿਲੋਗੇ ਮੈਨੂੰ ਠੀਕ ਹੈ ਮੈਮ